ਹੈਲੋ ਹਾਂਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਜੀ ਹਾਂਜੀ

ਸਾਡੇ ਦੋ ਤਿੰਨ ਘਰ ਨੇ ਜੀ ਇੱਕ ਤਾਂ ਜਿਵੇਂ ਹਾਂਜੀ ਇਹ ਤਾਂ ਜਿਵੇਂ ਮੰਨ ਲਓ ਆਪਣੇ ਗੁਲਸ਼ਨ ਸਵੀਟ ਹਾਊਸ ਵਾਲੇ ਇਹਨਾਂ ਤੋਂ ਤੁਹਾਨੂੰ ਮਿਠਾਈ ਵਗੈਰਾ ਮਿਠਾਈ ਵਗੈਰਾ ਜੀ ਜਿਵੇਂ ਜੀ ਉਹਨਾਂ ਦੇ ਗਰਮ ਗੁਲਾਬ ਜਾਮੁਨ ਹਾਂਜੀ ਇਹ ਬਹੁਤ ਮਸ਼ਹੂਰ ਨੇ ਉਹਨਾਂ ਦੇ ਅਤੇ ਹੋਰ ਆਪਣੇ ਆਰਤੀ ਸਵੀਟ ਹਾਊਸ ਵਾਲੇ ਨੇ ਹਾਂਜੀ ਉਹਨਾਂ ਦੀ ਉਹਨਾਂ ਉਹਨਾਂ ਦੀ ਹੈਗੀ ਜੀ ਰਸਮਲਾਈ ਰਸਮਲਾਈ ਉਹਨਾਂ ਦੀ ਮਸ਼ਹੂਰ ਹੈ ਜੀ ਜੀ ਹਾਂਜੀ ਹਾਂਜੀ ਜਮਾਂ ਫਰੈਸ਼ ਹਾਂਜੀ ਹਾਂਜੀ ਹਾਂਜੀ ਜਮਾਂ ਫਰੈਸ਼ ਮਿਲੇਗੀ ਹਾਂਜੀ ਆਈਸ ਕ੍ਰੀਮ ਸਾਡੇ ਇੱਕ ਦੋ ਕੁ ਹੈਗੇ ਜੀ ਸਾਡੇ ਆਈਸ ਕ੍ਰੀਮ ਵਾਲਾ ਜੀ ਜੀ ਉਹਨਾਂ ਦੀ ਆਈਸ ਕ੍ਰੀਮ ਬਹੁਤ ਮਸ਼ਹੂਰ ਹੈ ਬਹੁਤ ਯਾਨੀ ਕਿ ਟੇਸਟੀ ਹੁੰਦੀ ਹੈ ਹਾਂਜੀ ਆਈਸ ਆਈਸ ਕ੍ਰੀਮ ਜੀ ਮਨ ਲਓ ਡਰਾਈ ਫਰੂਟ ਹੈ ਜਾਂ ਹੋਰ ਖੋਇਆ ਹੈ ਕਈ ਵਰੈਟੀਆਂ ਨੇ ਜੀ ਉਹਨਾਂ 'ਚ ਜੋ ਆਪਦੀ ਇੱਛਾ ਨਹੀਂ ਨਹੀਂ ਨਹੀਂ ਇੱਕ ਨੰਬਰ ਹੋਵੇਗਾ ਕੋਈ ਮਿਕਸ ਨਹੀਂ ਹੋਵੇਗੀ ਕੋਈ ਕੁਆਲਿਟੀ ਹੋਵੇਗੀ ਯਾਨੀ ਕਿ ਹਾਂਜੀ